ਵਸਦੇ ਪਿੰਡ ਸ਼ਹਿਰਾਂ ਵਿੱਚ ਸਿਹਤ ਸੰਭਾਲ ਲਈ ਗੌਰਮੈਂਟ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਸਬਿਆਂ ਵਿੱਚ ਛੋਟੇ ਛੋਟੇ ਡਿਸਪੈਂਸਰੀਆਂ ਖੋਲ੍ਹਣ ਸ਼ਹਿਰਾਂ ਵਿੱਚ ਸ ਹੋਸਪਿਟਲ ਖੋਲ੍ਹਣ ਜਿਨ੍ਹਾਂ ਨਾਲ ਸੈਰ ਸਪਾਟੇ ਵਾਸਤੇ ਪਾਰਕਿੰਗ ਬਣਾਉਣ ਜਿੱਥੇ ਯੋਗਾ ਵਗੈਰਾ ਦੇ ਸਿਖਲਾਈ ਵਾਸਤੇ ਅਧਿਆਪਕ ਰੱਖੇ ਜਾਣ ਜਿਹੜੇ ਕਿ ਉਹਨਾਂ ਲੋਕਾਂ ਨੂੰ ਉਹਨਾਂ ਦੀ ਸਿਹਤ ਬਾਰੇ ਦੱਸਣ ਉਹ ਜੋਗਾ ਵਗੈਰਾ ਬਾਰੇ ਸ ਕਰਵਾਉਣ ਔਰ ਇਸਦੇ ਨਾਲ ਨਾਲ ਸ਼ਹਿਰ ਦੇ ਵਿੱਚ ਆਵਾਜਾਈ ਦੇ ਸਾਧਨ ਜਿਹੜੇ ਆ ਉਹ ਜਿੱਦਾਂ ਆਟੋ ਰਿਕਸ਼ਾ ਮਿਨੀ ਬੱਸਾਂ ਹੋਰ ਦੂਸਰੇ ਜਿਹੜੇ ਵੀ ਆਵਾਜਾਈ ਦੇ ਸਾਧਨ ਹਨ ਉਹਨਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਜਿਹਦੇ ਨਾਲ ਕਿ ਲੋਕਾਂ ਨੂੰ ਆਉਣ ਪਿੰਡਾਂ ਤੋਂ ਸ਼ਹਿਰਾਂ ਆਉਣ ਜਾਣ ਵਾਸਤੇ ਕੋਈ ਔਖਿਆਈ ਨਾ ਹੋਵੇ ਇਸ ਤਰ੍ਹਾਂ ਸਿੱਖਿਆ ਦੀ ਤਿਆਰੀ ਅੰਦਰ ਗੋ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਾਇਮਰੀ ਸਕੂਲ ਪਿੰਡਾਂ ਵਿੱਚ ਖੋਲ੍ਹਣ ਜਿਹਨਾਂ ਨਾਲ ਕਿ ਬੱਚਿਆਂ ਨੂੰ ਪੜ੍ਹਾਈ ਮਿਲ ਸਕੇ ਔਰ ਵਧੀਆ ਟੀਚਰ ਉੱਥੇ ਰੱਖੇ ਜਾਣ ਜਿਹਦੇ ਨਾਲ ਕਿ ਬੱਚਿਆਂ ਨੂੰ ਪੜ੍ਹਾਈ ਦਾ ਵਧੀਆ ਮਿਲੇ ਪਰ ਬੱਚੇ ਸਾਡੇ ਪੜ੍ਹ ਕੇ ਲਿਖ ਕੇ ਅੱਗੇ ਖੁਸ਼ਹਾਲ ਹੋਣ ਇਸ ਤਰ੍ਹਾਂ ਇਹ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਸਾਡੇ ਪਰੋਆ ਸ਼ਹਿਰ ਵਾਸਤੇ ਸਾਡੇ ਲੋਕਾਂ ਵਾਸਤੇ ਬਹੁਤ ਹੀ ਜ਼ਰੂਰੀ ਹਨ ਇਹਨਾਂ ਲੋਕਾਂ ਇਹਨਾਂ ਚੀਜ਼ਾਂ ਦੀ ਅਸੀਂ ਉਮੀਦ ਰੱਖਦੇ ਹਾਂ ਕਿ ਸਰਕਾਰ ਇਹਨਾਂ ਸ਼ਹਿਰ ਨੂੰ ਖੁਸ਼ਹਾਲ ਅਤੇ ਪਿੰਡਾਂ ਬਣਾਉਣ ਵਾਸਤੇ ਇਹਨਾਂ ਚੀਜ਼ਾਂ ਦਾ ਖ਼ਾਸ ਖਿਆਲ ਰੱਖੇ